ਜੇਕਰ ਗਾਇਕੀ ਵਿੱਚ ਗਤੀਸ਼ੀਲਤਾ ਵਿਕਾਸ ਅਤੇ ਵਿਆਖਿਆ ਨੂੰ ਸ਼ਾਮਿਲ ਕਰਨ ਦੀ ਗੱਲ ਕਰੀਏ ਤਾਂ ਅਸੀਂ ਗਾਇਕੀ ਦੀ ਆਵਾਜ਼ ਨੂੰ ਜ਼ਿੰਦਾ ਦਿਲ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਆਪਾਂ ਗਤੀਸ਼ੀਲਤਾ ਆਵਾਜ਼ ਦੀ ਉਤਾਰ ਚੜਾਅ ਨੂੰ ਪ੍ਰਯੋਗ ਕਰ ਸਕਦੇ ਹਾਂ ਜਿਵੇਂ ਸੁਰ ਦੀ ਉੱਚਾਈ ਅਤੇ ਘਟਾ ਗਾਣੇ ਦੇ ਲਹਿਜ਼ੇ ਨੂੰ ਢੰਗ ਨਾਲ ਪੇਸ਼ ਕਰਨ ਲਈ ਆਵਾਜ਼ ਨੂੰ ਕਦੇ ਹੌਲੀ ਕਦੇ ਉੱਚੀ ਰੱਖਣੀ ਪੈਂਦੀ ਹੈ ਸੰਪੂਰ ਝਟਕੇ ਗੀਤ ਦੀ ਉਤਸ਼ਾਹਨਾ ਵਧਾਉਣ ਲਈ ਆਵਾਜ਼ ਨੂੰ ਹੌਲੀ ਹੌਲੀ ਤੇਜ਼ ਕਰਨਾ ਜਾਂ ਫਿਰ ਨਰਮ ਕਰਨਾ ਵਿਕਾਸ ਗਾਇਕੀ ਵਿੱਚ ਗਹਿਰਾਈ ਅਤੇ ਨਵੀਨਤਾ ਸਰਗਮ ਅਤੇ ਮੁੜਾਵਟ ਗੀਤ ਦੀ ਮੁੱਖ ਲਾਈਨਾਂ ਵਿੱਚ ਨਵੇਂ ਸੁਰੀਲੇ ਅੰਸ਼ ਜੋੜੀਏ ਰਾਗ ਅਤੇ ਧਾੜ ਦੀ ਸਮਝ ਰਾਗਾਂ ਦੀ ਧੀਰੀ ਅਤੇ ਅਧਾਰਤ ਗਾਇਕੀ ਵਿੱਚ ਨਵੀਆਂ ਬਾਰੀਕੀਆਂ ਜੋੜ ਅਤੇ ਸਰੋਤਿਆਂ ਨੂੰ ਇੱਕ ਨਵਾਂ ਅਨੁਭਵ ਦੇਣਾ ਵਿਆਖਿਆ ਗੀਤ ਦੀ ਅਬੀਵ ਯਕਤੀ ਅਲੰਕਾਰ ਜਿਵੇਂ ਮੀਂਡ ਗਮਕ ਅਲਾਪ ਅਤੇ ਮੁੜਕੀਆਂ ਵਰਤ ਕੇ ਗੀਤ ਵਿੱਚ ਸੁੰਦਰਤਾ ਲਿਆਉਣੀ ਲਫਜ਼ਾਂ ਦੀ ਵਿਆਖਿਆ ਹਰੇਕ ਸ਼ਬਦ ਨੂੰ ਉਸ ਦੀ ਮਹੱਤਤਾ ਮੁਤਾਬਕ ਗਾਉਣਾ ਤਾਂ ਜੋ ਸੁਣਨ ਵਾਲੇ ਨੂੰ ਅਸਲ ਅਰਥ ਸਮਝ ਆ ਸਕੇ ਅਸੀਂ ਇਹ ਚੀਜ਼ਾਂ ਆਪਣੇ ਗਾਇਕੀ ਵਿੱਚ ਗਤੀਸ਼ੀਲਤਾ ਵਿਕਾਸ ਅਤੇ ਵਿਆਖਿਆਨ ਵਿੱਚ ਸ਼ਾਮਿਲ ਕਰ ਸਕਦੇ ਹਾਂ ਆਵਾਜ਼ ਨੂੰ ਗੁੰਝਲਦਾਰਤਾ ਕਦੇ ਕੋਮਲਤਾ ਕਦੇ ਸ਼ਕਤੀਸ਼ਾਲੀ ਆਵਾਜ਼ ਦੀ ਵਰਤੋਂ ਕਰਕੇ ਭਾਵਨਾਵਾਂ ਨੂੰ ਵਧਾ ਸਕਦੇ ਹਨ